ਨਮਸ਼ਕਾਰ ਜੀ ਮੇਰਾ ਨਾਮ ਸ਼ਸ਼ੀ ਹੈ ਮੈਂ ਗੁਰਦਾਸਪੁਰ ਦੀ ਰਹਿਣ ਵਾਲੀ ਹਾਂ ਗੁਰਦਾਸਪੁਰ ਦੀ ਇਸਲਾਮਾਬਾਦ ਮੁਹੱਲੇ 'ਚ ਰਹਿਣ ਵਾਲੀ ਹਾਂ ਅਤੇ ਮੈਂ ਦਸਵੀਂ ਪੜ੍ਹੀ ਹੋਈ ਹਾਂ ਅਤੇ ਅੱਜ ਦਾ ਜਿਹੜਾ ਹੈਗਾ ਵੀ ਪੰਜਾਬ ਦੇ ਵਿੱਚ ਪੰਜਾਬੀ ਦਾ ਕੀ ਇਹਦੇ ਵਿੱਚ ਇਹ ਹੈ ਕਿ ਸਾਡਾ ਪੰਜਾਬ ਨੂੰ ਪੰਜਾਬੀ ਦੇ ਨਾਲ ਹੀ ਜੋੜਿਆ ਜਾਂਦਾ ਹੈ ਇਸ ਕਰਕੇ ਵੀ ਜਿਹੜਾ ਵੀ ਇਹੀ ਕੰਮ ਆ ਸਾਡੀ ਪਹਿਲੀ ਮਾਤਰ ਭਾਸ਼ਾ ਪੰਜਾਬ ਦੀ ਪੰਜਾਬੀ ਹੀ ਗਿਣੀ ਜਾਂਦੀ ਹੈ ਇਸ ਕਰਕੇ ਅਸੀਂ ਜਿਹੜਾ ਵੀ ਕੋਈ ਸਰਕਾਰੀ ਕੰਮ ਕੋਈ ਵੀ ਫਾਰਮ ਵਗੈਰਾ ਭਰਨਾ ਹੋਵੇ ਅਸੀਂ ਉਹਨੂੰ ਪੰਜਾਬੀ 'ਚ ਹੀ ਭਰਦੇ ਹਾਂ ਅਸੀਂ ਚਾਹੁੰਦੇ ਹਾਂ ਵੀ ਸਾਡੀ ਜਿਹੜੀ ਮਾਤਰ ਭਾਸ਼ਾ ਹੈ ਹਰ ਭਾਸ਼ਾ ਵਿੱਚ ਹੀ ਇਹਨੂੰ ਹੀ ਆਪਣਾ ਇਸਤੇਮਾਲ ਕਰੀਏ ਅਤੇ ਹੋਰ ਅਸੀਂ ਚੰਦ ਹੋਰ ਤੁਸੀਂ ਜਾਣਦੇ ਹੋ ਵੀ ਅੱਜ ਕੱਲ੍ਹ ਦੀਆਂ ਜਿਹੜਾ ਟਾਈਮ ਆ ਮਾਂ ਪਿਓ ਚਾਹੁੰਦੇ ਵੀ ਸਾਨੂੰ ਪੰਜਾਬੀ ਦੀ ਜਗ੍ਹਾ ਬੱਚੇ ਇੰਗਲਿਸ਼ ਹਿੰਦੀ ਪੜ੍ਹਣ ਜਦਕਿ ਇਹ ਗਲਤ ਹੈ ਹਰ ਭਾਸ਼ਾ ਦਾ ਆਪਣਾ ਆਪਣਾ ਮਹੱਤਵ ਹੁੰਦਾ ਆ ਅਤੇ ਇਸ ਕਰਕੇ ਸਾਨੂੰ ਸਾਡੀ ਪਹਿਲੀ ਪਹਿਲ ਵਿੱਚ ਪੰਜਾਬੀ ਹੀ ਪਹਿਲ ਆਉਂਦੀ ਹੈ ਅਤੇ ਆਪਣੀ ਜਗ੍ਹਾ 'ਤੇ ਹਿੰਦੀ ਇੰਗਲਿਸ਼ ਵੀ ਠੀਕ ਆ ਪਰ ਉਹਨੂੰ ਉਹਦੇ ਵਿੱਚ ਹੀ ਲੈਣਾ ਚਾਹੀਦਾ ਵੀ ਜਿੰਨੀ ਕਿ ਸਾਨੂੰ ਜ਼ਰੂਰਤ ਆ ਪਹਿਲੇ ਸਾਡੀ ਮਾਤਰ ਭਾਸ਼ਾ ਆ ਫਿਰ ਅਸੀਂ ਆਪਣੀ ਦੂਜੀ ਭਾਸ਼ਾ ਨੂੰ ਕਰਾਂਗੇ ਅਤੇ ਹੋਰ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਬੱਚਿਆਂ ਨੂੰ ਹਰ ਭਾਸ਼ਾ ਆਉਣੀ ਬਹੁਤ ਜ਼ਰੂਰੀ ਹੈ ਕਿਉਂਕਿ ਜੇ ਅਸੀਂ ਆਪਣੇ ਪੰਜਾਬੀ ਨੂੰ ਭੁੱਲ ਜਾਵਾਂਗੇ ਕੱਲ੍ਹ ਨੂੰ ਸਾਨੂੰ ਕੋਈ ਵੀ ਕਿਸੇ 'ਚ ਜਾਵਾਂਗੇ ਅਤੇ ਉਹ ਸਾਨੂੰ ਵਿੱਚ ਮੁਸ਼ਕਿਲ ਹੋ ਜਾਂਦੀ ਜਿਵੇਂ ਅਸੀਂ ਪੰਜਾਬ ਦੇ ਰਹਿਣ ਵਾਲੇ ਸਾਨੂੰ ਪੰਜਾਬੀ ਬਹੁਤ ਜ਼ਰੂਰੀ ਹੈ ਜਿਵੇਂ ਅਸੀਂ ਦੂਸਰੇ ਸ਼ਹਿਰਾਂ 'ਚ ਚਲ ਜਾਂਦੇ ਹਾਂ ਤਾਂ ਉਹਦੇ ਵਿੱਚ ਸਾਨੂੰ ਹਿੰਦੀ ਜਾਨੀ ਕਿ ਦਿੱਲੀ ਵਿੱਚ ਜਾਂਦੇ ਸਾਨੂੰ ਉਹਦੇ 'ਚ ਹਿੰਦੀ ਦੀ ਜ਼ਰੂਰਤ ਪੈਂਦੀ ਹੈ ਇਸ ਤਰ੍ਹਾਂ ਅੱਜ ਦੇ ਟਾਈਮ ਦੇ ਵਿੱਚ ਆਪਣੇ ਮਾਤਰ ਭਾਸ਼ਾ ਹੀ ਬਹੁਤ ਜ਼ਰੂਰੀ ਆ ਅਤੇ ਸਾਨੂੰ ਉਹਦਾ ਮਾਣ ਵੀ ਕਰਨਾ ਚਾਹੀਦਾ ਵਾ ਜੇ ਅਸੀਂ ਆਪਣੀ ਭਾਸ਼ਾ ਨੂੰ ਅੱਗੇ ਲਵਾਂਗੇ ਅਤੇ ਫੇਰ ਅਸੀਂ ਕਾਮਯਾਬ ਹੋਵਾਂਗੇ ਅਤੇ ਇਹਦੇ ਨਾਲ ਇਹ ਹੈ ਵੀ ਸਾਡੇ ਬੱਚਿਆਂ ਨੂੰ ਜਦੀ ਆਪਣੀ ਮਾਤਰ ਭਾਸ਼ਾ ਨਾਲ ਜੋੜਾਂਗੇ ਅਤੇ ਅਸੀਂ ਸਾਡੇ ਬੱਚੇ ਅੱਗੇ ਤਰੱਕੀਆਂ ਵੀ ਕਰ ਸਕਦੇ ਇਹ ਆਪਣਾ ਪੰਜਾਬ ਦੀ ਭਾਸ਼ਾ ਪਹਿਲੀ ਭਾਸ਼ਾ ਪੰਜਾਬੀ ਹੈ ਅਤੇ ਧੰਨਵਾਦ